ਰੂਪਨਗਰ ਜ਼ਿਲ੍ਹੇ ਦੀ ਜੋ ਸਥਾਨਕ ਖੇਡਾਂ ਉਹਨਾਂ 'ਚ ਆਉਂਦੇ ਜਿਵੇਂ ਗੱਤਕੇ ਅਖਾੜੇ ਇੱਥੇ ਬਹੁਤ ਸਾਰੇ ਗੱਤਕਾ ਅਖਾੜੇ ਲੱਗਦੇ ਹਨ ਗੱਤਕਾ ਦੇ ਗਰੁੱਪਸ ਬਣੇ ਹੋਏ ਹਨ ਉਨ੍ਹਾਂ 'ਚ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਬੱਚਿਆਂ ਨੂੰ ਭੁਜੰਗੀ ਬਣਾ ਕੇ ਸੋਟੀਆਂ ਕਿਰਪਾਨਾਂ ਅਤੇ ਢਾਲਾਂ ਵਗੈਰਾ ਨਾਲ ਬੱਚਿਆਂ ਨੂੰ ਲੜਨਾ ਸਿਖਾਇਆ ਜਾਂਦਾ ਇੱਕ ਵਧੀਆ ਆਤਮ ਸੁਰੱਖਿਆ ਦੀ ਖੇਡ ਹੈ ਜਿਹਦੇ 'ਚ ਬੱਚੇ ਆਪਣੀ ਸੁਰੱਖਿਆ ਵੀ ਕਰ ਸਕਦੇ ਹੈ ਅਤੇ ਕਿਸੇ ਗਰੀਬ ਮਜ਼ਲੂਮ ਦੀ ਸੁਰੱਖਿਆ ਵੀ ਕਰ ਸਕਦੇ ਹੈ ਅਤੇ ਇਹਦੇ ਨਾਲ ਸਰੀਰਕ ਕਸਰਤ ਵੀ ਹੁੰਦੀ ਹੈ ਅਤੇ ਬੱਚਿਆਂ ਦੀ ਸਿਹਤ ਠੀਕ ਰਹਿੰਦੀ ਹੈ ਅਤੇ ਉਨ੍ਹਾਂ ਦਾ ਜਿਹੜਾ ਸਮਾਂ ਹੈ ਉਹ ਸਹੀ ਪਾਸੇ ਲੱਗਦਾ ਅਤੇ ਉਹਨਾਂ ਦੀ ਤਾਕਤ ਨੂੰ ਸਹੀ ਪਾਸੇ ਚੈਨੇਲਾਇਜ਼ ਕੀਤਾ ਜਾਂਦਾ ਅਤੇ ਬੱਚੇ ਜਿਹੜੇ ਉਹਦੇ 'ਚ ਉਹਨਾਂ ਦਾ ਜਿੱਥੇ ਮਨੋਰੰਜ਼ਨ ਵੀ ਹੁੰਦਾ ਉੱਥੇ ਉਹ ਆਪਣੇ ਇੱਕ ਧਰਮ ਨਾਲ ਵੀ ਜੁੜੇ ਰਹਿੰਦੇ ਹੈ ਅਤੇ ਉਨ੍ਹਾਂ ਨੂੰ ਸਿੱਖਿਆ ਮਿਲਦੀ ਹੈ ਕਿ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਅਤੇ ਕਿਸੇ ਗਰੀਬ ਮਜ਼ਲੂਮ ਦੀ ਰਾਖੀ ਕਰਨੀ ਹੈ ਔਰ ਇਹਦੇ ਵਿੱਚ ਸਾਰੇ ਗਰੁੱਪਸ ਵਿੱਚ ਮਿਲ ਕੇ ਬੱਚੇ ਜੋ ਹੈ ਗੱਤਕਾ ਸਿੱਖਦੇ ਹੈ ਇਹਦੇ ਨਾਲ ਆਪਸੀ ਪਿਆਰ ਅਤੇ ਭਰਾਤਰੀ ਭਾਵਨਾ ਦਾ ਵਾਧਾ ਹੁੰਦਾ ਔਰ ਇਹ ਸਾਡੀ ਪਰੰਪਰਾ ਵੀ ਹੈ ਅਤੇ ਸਾਡੇ ਗੁਰੂ ਸਹਿਬਾਨਾਂ ਨੇ ਮੁੱਢ ਕਦੀਮ ਤੋਂ ਹੀ ਬੱਚਿਆਂ ਨੂੰ ਜੋ ਹੈ ਗੱਤਕਾ ਦੀ ਸਿਖਲਾਈ ਬੱਚਿਆਂ ਅਤੇ ਵੱਡਿਆਂ ਨੂੰ ਗੱਤਕਾ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ ਸੀ ਔਰ ਉਨ੍ਹਾਂ ਨੂੰ ਜੰਗਾਂ ਯੁੱਧਾਂ ਲਈ ਤਿਆਰ ਕੀਤਾ ਸੀ ਇਸਦੇ ਨਾਲ ਜਿੱਥੇ ਮਨੋਰੰਜਨ ਹੁੰਦਾ ਉੱਥੇ ਉਨ੍ਹਾਂ 'ਚ ਆਪਸੀ ਪਿਆਰ ਪ੍ਰੇਮ ਭਾਈਚਾਰਾ ਵੱਧਦਾ ਅਤੇ ਉਹਨਾਂ ਨੂੰ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਦੇ ਲਈ ਉਨ੍ਹਾਂ ਦੇ ਵਿੱਚ ਯੋਗਤਾ ਪੈਦਾ ਕੀਤੀ ਜਾਂਦੀ ਹੈ